ਪੰਜਾਬ ਵਿੱਚ ਜੋ ਮੁੱਖ ਧਰਮ ਹਨ ਜਿਵੇਂ ਕਿ ਸਿੱਖ ਧਰਮ ਹੈ ਹਿੰਦੂ ਧਰਮ ਹੈ ਇਸਲਾਮ ਧਰਮ ਹੈ ਈਸਾਈ ਧਰਮ ਹੈ ਇਹ ਸਾਰੇ ਧਰਮ ਪੰਜਾਬ ਵਿੱਚ ਹੈਗੇ ਆ ਪਰ ਮੁੱਖ ਤੌਰ 'ਤੇ ਜੋ ਪੰਜਾਬ ਦਾ ਵਿੱਚ ਸਿੱਖ ਧਰਮ ਜ਼ਿਆਦਾ ਪ੍ਰਚਲਿਤ ਹੈ ਅਤੇ ਕਿਉਂਕਿ ਇੱਥੇ ਸਿੱਖ ਆਬਾਦੀ ਵੀ ਜ਼ਿਆਦਾ ਹੈ ਅਤੇ ਜੋ ਸਿੱਖ ਦੀ ਜੋ ਖਾਲਸੇ ਪੰਥ ਦੀ ਸਾਜਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਉਦੋਂ ਤੋਂ ਉਹਨਾਂ ਨੇ ਸਿੱਖੀ ਨੂੰ ਇੱਕ ਅਲੱਗ ਪਹਿਚਾਣ ਦਿੱਤੀ ਸੀ ਅਤੇ ਸਿੱਖ ਸਿਰ ਦੇ ਉੱਤੇ ਪੱਗੜੀ ਬੰਨਦਾ ਹੈ ਅਤੇ ਉਸ ਦੀ ਦਾੜ੍ਹੀ ਹੁੰਦੀ ਹੈ ਅਤੇ ਜੋ ਇੱਥੇ ਗੁਰਦੁਆਰੇ ਬਣੇ ਹੋਏ ਹਨ ਬਹੁਤ ਜ਼ਿਆਦਾ ਪੰਜਾਬ 'ਚ ਗੁਰਦੁਆਰੇ ਬਣੇ ਹੋਏ ਹਨ ਉਨ੍ਹਾਂ ਵਿੱਚ ਬਿਨਾਂ ਕਿਸੇ ਭੇਦ ਭਾਵ ਤੋਂ ਚੌਵੀ ਘੰਟੇ ਲੰਗਰ ਦੀ ਸੇਵਾ ਜੋ ਚੱਲਦੀ ਰਹਿੰਦੀ ਹੈ ਉਹ ਬਿਲਕੁਲ ਫ੍ਰੀ ਹੈ ਕਿਸੇ ਤੋਂ ਵੀ ਕੋਈ ਪੈਸਾ ਨਹੀਂ ਲਿਆ ਜਾਂਦਾ ਇਸ ਤੋਂ ਇਲਾਵਾ ਪੰਜਾਬ ਵਿੱਚ ਧਾਰਮਿਕ ਸਮਾਗਮ ਜਿਵੇਂ ਕਿ ਸ਼ਹੀਦੀ ਜੋੜ ਮੇਲੇ ਜੋ ਕਿ ਰੋਪੜ ਤੋਂ ਸ਼ੁਰੂ ਹੋ ਕੇ ਫਤਿਹਗੜ੍ਹ ਸਾਹਿਬ ਗੁਰਦੁਆਰੇ ਤੋਂ ਹੁੰਦੇ ਹੋਏ ਅਖੀਰ ਵਿੱਚ ਮੁਕਤਸਰ ਸਾਹਿਬ ਜਾ ਕੇ ਸਮਾਪਤ ਹੁੰਦੇ ਹਨ ਇਹਨਾਂ ਵਿੱਚ ਸਾਰਾ ਹੀ ਪੰਜਾਬ ਸ਼ੋਕ ਦੀ ਲਹਿਰ ਵਿੱਚ ਹੁੰਦਾ ਹੈ ਅਤੇ ਉਸ ਸਮੇਂ ਇਹ ਵੀ ਵਿਸ਼ਵਾਸ਼ ਲੋਕਾਂ ਨੂੰ ਵੱਲੋਂ ਕੀਤਾ ਜਾਂਦਾ ਹੈ ਕਿ ਜੋ ਗੁਰੂ ਸਾਹਿਬ ਦੇ ਪਰਿਵਾਰ ਨਾਲ ਹੋਇਆ ਸੀ ਉਹ ਅਸੀਂ ਵੀ ਆਪਣੇ ਪਿੰਡੇ 'ਤੇ ਹੰਢਾ ਕੇ ਦੇਖੀਏ ਅਤੇ ਕਈ ਪੁਰਾਣੇ ਬਜ਼ੁਰਗ ਤਾਂ ਹਾਲੇ ਵੀ ਰਾਤਾਂ ਨੂੰ ਥੱਲੇ ਧਰਤੀ 'ਤੇ ਸਰਦੀਆਂ ਦੇ ਵਿੱਚ ਸੌਣ ਦੀ ਕੋਸ਼ਿਸ਼ ਕਰਦੇ ਹਨ ਤਾਂਕਿ ਉਹ ਉਸ ਸਮੇਂ ਦੇ ਸੰਤਾਪ ਨੂੰ ਹੰਢਾ ਸਕਣ ਇਸ ਤੋਂ ਇਲਾਵਾ ਨਗਰ ਕੀਰਤਨ ਜੋ ਪੰਜਾਬ ਵਿੱਚ ਨਿਕਲਦੇ ਹਨ